ਮੇਰੇ ਸ਼ੌਕਾਂ ਬਾਰੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡਾ ਸ਼ੌਂਕ ਮੇਰਾ ਸ ਪੜ੍ਹਨਾ ਹੀ ਹੈ ਪੜ੍ਹਾਈ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਹੈ ਜਿਵੇਂ ਹੁਣ ਮੈਂ ਆਪਣੀ ਗ੍ਰੈਜੂਏਸ਼ਨ ਵੀ ਕੰਪਲੀਟ ਕਰ ਲਈ ਹੈ ਹੁਣ ਮੈਂ ਫਰੀ ਹੁੰਦੀ ਹਾਂ ਬਟ ਮੈਂ ਨਾਲ਼ ਨਾਲ਼ ਆਪਣੇ ਸਟੱਡੀ ਵੀ ਕਰਦੀ ਰਹਿੰਦੀ ਹਾਂ ਹ ਘਰ ਬੈਠ ਕੇ ਹੀ ਅਤੇ ਉਸ ਤੋਂ ਇਲਾਵਾ ਮੈਨੂੰ ਬੁਕਸ ਰੀਡ ਕਰਨ ਦਾ ਵੀ ਸ਼ੌਂਕ ਹੈ ਜਿਵੇਂ ਹੁਣ ਮੈਂ ਫਰੀ ਹੁੰਦੀ ਹਾਂ ਘਰ ਤਾਂ ਮੈਂ ਆਪਣੀ ਮੰਮੀ ਦੀ ਵੀ ਹੈਲਪ ਕਰਵਾਉਂਦੀ ਰਹਿੰਦੀ ਹਾਂ ਕਿਚਨ 'ਚ ਉਸ ਤਰ੍ਹਾਂ ਮੈਨੂੰ ਕੁਕਿੰਗ ਦਾ ਵੀ ਥੋੜ੍ਹਾ ਬਹੁਤ ਸ਼ੌਂਕ ਹੈਗਾ ਏ ਹੋਰ ਗੱਲ ਕੀਤੀ ਜਾਵੇ ਤਾਂ ਮੈਂ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਉਂਦੀ ਹਾਂ ਜੇ ਅਤੇ ਡਾਂਸਿੰਗ ਵਗੈਰਾ ਦਾ ਵੀ ਬਹੁਤ ਸ਼ੌਂਕ ਹੈ ਇਹੀ ਸਭ ਮੇਰੇ ਸ਼ੌਂਕ ਹਨ